ਪਾਣੀ ਪਾਣੀ ਸਾਡੇ ਸਰੀਰ ਲਈ ਵੈਸੇ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਭੋਜਨ ਨੂੰ ਪਚਾਣ ਲਈ ਵੀ ਪਾਣੀ ਚਾਹੀਦਾ ਭੋਜਨ ਖਾਣ ਤੋਂ ਬਾਅਦ ਜਿਹੜਾ ਅਸੀਂ ਪਾਣੀ ਪੀਂਦੇ ਹਾਂ ਉਹ ਸਾਡੇ ਭੋਜਨ ਨੂੰ ਪਚਾਉਣ ਦੀ ਕੋਸ਼ਿਸ਼ ਕਰਦਾ ਰਾਤੀ ਜਦੋਂ ਸਵੇਰੇ ਉੱਠਦੇ ਹਾਂ ਸਵੇਰੇ ਉੱਠ ਕੇ ਪਾਣੀ ਪੀਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜ਼ਰੂਰਤ ਵੀ ਹੈ ਔਰ ਪਿਆਸ ਵੀ ਲੱਗੀ ਹੁੰਦੀ ਹੈ ਪਾਣੀ ਯੂਰਿਕ ਐਸਿਡ ਲਈ ਵੀ ਜ਼ਰੂਰੀ ਹੁੰਦਾ ਹੈ ਇਸ ਕਰਕੇ ਪਾਣੀ ਦੀ ਸਰੀਰ ਵਿੱਚ ਟਰਾਂਜੈਕਸ਼ਨ ਹੋਣਾ ਸਰੀਰ ਦੇ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ ਕੁਛ ਕਈ ਵਾਰ ਅਸੀਂ ਓਇਲਡ ਚੀਜ਼ਾਂ ਖਾ ਲੈਂਦਾ ਫਰਾਈਡ ਖਾ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਪਾਣੀ ਦੀ ਵੈਸੇ ਵੀ ਜ਼ਰੂਰਤ ਬਣ ਜਾਂਦੀ ਹੈ ਪਾਣੀ ਸਵੇਰੇ ਸ਼ਾਮ ਪੀਣਾ ਸਿਹਤ ਲਈ ਲਾਭਦਾਇਕ ਹੁੰਦਾ ਹੈ ਔਰ ਕਈ ਬਿਮਾਰੀਆਂ ਦਾ ਇਲਾਜ ਵੀ ਪਾਣੀ ਹੈ ਇਸ ਕਰਕੇ ਪਾਣੀ ਇੱਕ ਹੈਬਿਟ ਵੀ ਹੁੰਦੀ ਹੈ ਤਾਂ ਜੋ ਸਰੀਰ ਨੂੰ ਉਸ ਚੀਜ਼ ਦਾ ਬੈਨੀਫਿਟ ਮਿਲਦਾ ਰਹੇ ਇਸ ਕਰਕੇ ਪਾਣੀ ਅਸੀਂ ਵਾਰ ਵਾਰ ਪੀਂਦੇ ਹਾਂ ਤਾਂ ਜੋ ਸਾਡਾ ਸਰੀਰ ਜਿਹੜਾ ਹੈ ਉਹ ਰਿਸਟ ਪੁਸ਼ਟ ਰਹੇ ਅਤੇ ਛੋਟੀਆਂ ਮੋਟੀਆਂ ਪ੍ਰੋਬਲਮਸ ਉਸ ਨਾਲ ਹੀ ਖਤਮ ਹੁੰਦੀਆਂ ਰਹਿਣ ਇਸ ਕਰਕੇ ਅਸੀਂ ਪਾਣੀ ਵਾਰ ਵਾਰ ਦਿਨ ਵਿੱਚ ਕਈ ਵਾਰ ਪੀ ਲੈਂਦੇ ਹਾਂ ਪਾਣੀ ਪੀਣਾ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ